ਹੈਲੋ ਮੀਸ਼ੋ ਸਤਿ ਸ਼੍ਰੀ ਅਕਾਲ ਮੈਂ ਤੁਹਾਡੇ ਤੋਂ ਕੁਝ ਦਿਨ ਪਹਿਲਾਂ ਹੀ ਸ਼ੂਜ ਔਡਰ ਕੀਤੇ ਹਨ ਜੋ ਕਿ ਮੈਨੂੰ ਦੋ ਦਿਨ ਤਿੰਨ ਦਿਨ ਪਹਿਲਾਂ ਹੀ ਮਿਲ ਗਏ ਹਨ ਇਸ ਦਾ ਰੰਗ ਚਿੱਟੇ ਰੰਗ ਦਾ ਹੈ ਜੋ ਕਿ ਮੈਂ ਮੰਗਵਾਇਆ ਸੀ ਮੈਨੂੰ ਉਹ ਹੀ ਕਲਰ ਵਿੱਚ ਮਿਲਿਆ ਹੈ ਅਤੇ ਇਸ ਦੇ ਵਿੱਚ ਦੋ ਧਾਰੀਆਂ ਹਨ ਜੋ ਕਿ ਮੇਰੇ ਸੂਟਾਂ ਦੇ ਨਾਲ ਮੈਚ ਹੁੰਦੀਆਂ ਹਨ ਇਸ ਦੇ ਵਿੱਚ ਜਾਲੀ ਹੈ ਜੋ ਕਿ ਪਸੀਨੇ ਨੂੰ ਆਉਣ ਨਹੀਂ ਦਿੰਦੀ ਅਤੇ ਹਵਾ ਅੰਦਰ ਬਾਹਰ ਜਾਂਦੀ ਰਹਿੰਦੀ ਹੈ ਸੋਲ ਇਸ ਦਾ ਸੋਲ ਬਹੁਤ ਹੀ ਸੋਹਣਾ ਹੈ ਅਤੇ ਹਲਕਾ ਹੈ ਮੈਨੂੰ ਪਾਇਆ ਪਤਾ ਵੀ ਨਹੀਂ ਲੱਗਦਾ ਕਿ ਮੈਂ ਪੈਰਾਂ ਵਿੱਚ ਬੂਟ ਪਾਏ ਹੋਏ ਹਨ ਜਾਂ ਨਹੀਂ ਰੇਟ ਇਸ ਦਾ ਰੇਟ ਬਹੁਤ ਹੀ ਘੱਟ ਹੈ ਜਦੋਂ ਮੈਂ ਬਾਹਰ ਪਾ ਕੇ ਜਾਂਦੀ ਹਾਂ ਤਾਂ ਲੋਕ ਮੈਨੂੰ ਪੁੱਛਦੇ ਹਨ ਤੁਸੀਂ ਇਹ ਸ਼ੂਜ ਕਿੰਨੇ ਦੇ ਲਏ ਮਾਰਕੀਟ ਵਿੱਚ ਇਹਨਾਂ ਦਾ ਰੇਟ ਬਹੁਤ ਜ਼ਿਆਦਾ ਸੀ ਪਰ ਮੈਨੂੰ ਮੀਸ਼ੋ ਤੋਂ ਇਸ ਦਾ ਰੇਟ ਠੀਕ ਠੀਕ ਮਿਲ ਗਿਆ ਇਹ ਐਡੀਡਾਸ ਕੰਪਨੀ ਦੇ ਸ਼ੂਜ ਹਨ ਜੇ ਜੋ ਕਿ ਬਾਜ਼ਾਰ ਵਿੱਚ ਬਹੁਤ ਹੀ ਜ਼ਿਆਦਾ ਰੇਟ ਵਿੱਚ ਮਿਲਦੇ ਹਨ ਅਤੇ ਮੈਂ ਇਹਨਾਂ ਨੂੰ ਪਾ ਕੇ ਬਹੁਤ ਖੁਸ਼ ਹਾਂ ਮੈਨੂੰ ਜੋ ਮੈਂ ਚਾਹਿਆ ਸੀ ਮੈਨੂੰ ਉਹ ਹੀ ਮਿਲ ਗਿਆ ਮੈਂ ਮੀਸ਼ੋ ਕੰਪਨੀ ਦਾ ਧੰਨਵਾਦ ਕਰਦੀ ਹਾਂ